ਪੰਜ ਮਈ ਉੱਨੀ ਸੌ ਨੱਬੇ ਦਸ ਜੂਨ ਉੱਨੀ ਸੌ ਛਿਆਨਵੇਂ ਇੱਕ ਜਨਵਰੀ ਦੋ ਹਜ਼ਾਰ ਇੱਕ ਪੱਚੀ ਮਾਰਚ ਦੋ ਹਜ਼ਾਰ ਛੇ ਪੰਜ ਅਗਸਤ ਦੋ ਹਜ਼ਾਰ ਦਸ